ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਅੱਛਾ ਅੱਛਾ ਹਾਂਜੀ ਤੁਸੀਂ ਮ ਆਪਾਂ ਗੁਰਦੁਆਰੇ ਮਿਲੇ ਸੀ ਸ਼ਾਇਦ ਹੈ ਨਾ ਅੱਛਾ ਅੱਛਾ ਹੂੰ ਹੂੰ ਹਾਂ ਠੰਡ ਠੰਡ ਬਹੁਤ ਹੋ ਗਈ ਇੱਥੇ ਤਾਂ ਅੱਛਾ ਅੱਛਾ ਹਾਂ ਹਾਂ ਹਾਂ ਇੱਥੇ ਬੜੇ ਵਧੀਆ ਸਵੈਟਰ ਸਵੂਟਰ ਮਿਲ ਜਾਂਦੇ ਆਪਾਂ ਚੌੜੇ ਬਾਜ਼ਾਰ ਜਾ ਕੇ ਆਪਾਂ ਉੱਥੇ ਮੋਂਟੇ ਕਾਰਲੋ ਵਾਲੇ ਵੀ ਹੈਗੇ ਹੈ ਅਤੇ ਉਹਨਾਂ ਉਹਨਾਂ ਤੋਂ ਸਾਨੂੰ ਅੱਛੀ ਵਰਾਇਟੀ ਮਿਲ ਜਾਂਦੀ ਹੈ ਸਵੈਟਰ ਵਗੈਰਾ ਅਤੇ ਤੁਸੀਂ ਮੈਂ ਕੱਢ ਲਵਾਂਗੀ ਕੋਈ ਗੱਲ ਨਹੀਂ ਤੁਸੀਂ ਜਿੱਦਾਂ ਕਹੋਗੇ ਉੱਦਾਂ ਕਰ ਲਵਾਂਗੇ ਬਾਕੀ ਮਤਲਬ ਅੱਛਾ ਅੱਛਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਟਾਈਮ ਕੱਢ ਲੂੰਗੀ ਮੈਂ ਤੁਹਾਨੂੰ ਅੱਜ ਦਿਖਾ ਲਿਆਊਂਗੀ ਬੜੀਆਂ ਅੱਛੀਆਂ ਅੱਛੀਆਂ ਸ਼ੋਪਸ ਹੈਗੀਆਂ ਇੱਥੇ ਮਾਰਕੀਟ ਬੜੀ ਅੱਛੀ ਹੈ ਹੋਲਡਨ 'ਚ ਤਾਂ ਮਤਲਬ ਲੁਧਿਆਣੇ ਤੋਂ ਸਭ ਤੋਂ ਵਧੀਆ ਮਤਲਬ ਮਿਲਦਾ ਆ ਹੌਜ਼ਰੀ ਦਾ ਸਮਾਨ ਅਤੇ ਤੁਸੀਂ ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਲੁਧਿਆਣੇ ਦਾ ਹੀ ਬ੍ਰਾਂਡ ਬਹੁਤ ਪੁਰਾਣਾ ਇੰਨੇ ਮਤਲਬ ਪੁਰਾਣੇ ਸਮਿਆਂ ਤੋਂ ਚੱਲਦਾ ਆ ਰਿਹਾ ਅਤੇ ਹੋਰ ਵੀ ਇੱਥੇ ਮਤਲਬ ਅੱਛੀਆਂ ਸ਼ੋਪਸ ਹੈਗੀਆਂ ਤੁਸੀਂ ਮਤਲਬ ਉਹ ਵੀ ਹੈਗੇ ਆ ਸ਼ੋਲਜ ਵਗੈਰਾ ਇਹਨਾਂ ਕੋਲ ਅੱਛੀਆਂ ਹੁੰਦੀਆਂ ਕੋਟ ਵਗੈਰਾ ਬੜੇ ਅੱਛੇ ਹੈਗੇ ਆ ਹੈ ਨਾ ਤਾਂ ਅਤੇ ਹਾਂ ਤੁਹਾਨੂੰ ਮਤਲਬ ਪਿਓਰ ਪਿਓਰ ਵੂਲ 'ਚ ਹੀ ਚਾਹੀਦੇ ਆ ਜਾਂ ਕੈਸ਼ਮਿਲਾਨ ਵਗੈਰਾ ਵੀ ਚੱਲ ਜੂ ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਨਹੀਂ ਮੋਂਟੀ ਕਾਰਲੋ ਦਾ ਬ੍ਰਾਂਡ ਬਹੁਤ ਅੱਛਾ ਆ ਮਤਲਬ ਵਰਡਵਾਈਡ ਚੱਲਦਾ ਇਹ ਬਰੈਂਡ ਤਾਂ ਕੋਈ ਕੰਪਲੇਂਟ ਨਹੀਂ ਅਸੀਂ ਇੰਨੇ ਸਾਲਾਂ ਤੋਂ ਇੱਥੇ ਲੁਧਿਆਣੇ 'ਚ ਰਹਿ ਰਹੇ ਹਾਂ ਅਸੀਂ ਤਾਂ ਮਤਲਬ ਕਿ ਸ਼ੋਪਿੰਗ ਕਰਦੇ ਰਹਿੰਦੇ ਹਾਂ ਅਤੇ ਤੁਸੀਂ ਫਿਕਰ ਨਹੀਂ ਕਰਨੀ ਆਪਾਂ ਕੀ ਕਹਿੰਦੇ ਤੁਹਾਡੇ ਨਾਲ ਚੱਲ ਪਵਾਂਗੇ ਜਦੋਂ ਵੀ ਤੁਸੀਂ ਜਾਣਾ ਹੋਇਆ ਜਿੰਨੀ ਵਾਰੀ ਕਹੋਗੇ ਅਸੀਂ ਚੱਲ ਪਵਾਂਗੇ ਅਤੇ ਤੁਸੀਂ ਮੈਨੂੰ ਬਸ ਦੱਸ ਦਿਓ ਵੀ ਕਿੱਦਣ ਤੁਸੀਂ ਜਾਣਾ ਮੈਂ ਉਸ ਦਿਨ ਆਪਣਾ ਟਾਈਮ ਵੀ ਰੱਖਾਂਗੀ ਹੈ ਨਾ ਅਤੇ ਬਾਕੀ ਤਾਂ ਹੁਣ ਸਭ ਮੌਸਮ ਹੈ ਕੀ ਖਰਾਬ ਹੋ ਰਿਹਾ ਅਤੇ ਜ਼ਰੂਰਤ ਤਾਂ ਹੈਗੀ ਆ ਹੈ ਨਾ ਕੋਈ ਨਹੀਂ ਮੈਂ ਕੱਲ੍ਹ ਕੱਢਦੀ ਹਾਂ ਟਾਈਮ ਜੇ ਕੱਲ੍ਹ ਨਿਕਲ ਗਿਆ ਤਾਂ ਫਿਰ ਮੈਂ ਤੁਹਾਨੂੰ ਕਾਲ ਕਰ ਦਿਆਂਗੀ ਇਸ ਨੰਬਰ 'ਤੇ ਹੀ ਕਰਾਂ ਨਾ ਤੁਹਾਡਾ ਹੀ ਨੰਬਰ ਹੈ ਨਾ ਇਹ ਅੱਛਾ ਅੱਛਾ ਅੱਛਾ ਨਹੀਂ ਚਲੋ ਠੀਕ ਹੈ ਤੁਸੀਂ ਆਪਾਂ ਕੱਲ੍ਹ ਮਿਲਦੇ ਹਾਂ ਫਿਰ ਆਪਾਂ ਲੈ ਆਵਾਂਗੇ ਜੋ ਵੀ ਤੁਹਾਨੂੰ ਜਿਹੜੀ ਵੀ ਵੂਲ ਚਾਹੀਦੀ ਹੋਏਗੀ ਹੈ ਨਾ ਅਤੇ ਓਕੇ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ